ਹੈਲੋ ਔਲਾ ਡਰਾਈਵ ਵੇਅ ਸਤਿ ਸ਼੍ਰੀ ਅਕਾਲ ਜੀ ਮੈਂ ਅਨਮੋਲ ਪਟਿਆਲੇ ਤੋਂ ਗੱਲ ਕਰ ਰਿਹਾ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਕੈਬ ਅੱਜ ਰਾਤ ਗਿਆਰਾਂ ਵਜੇ ਲਈ ਪਟਿਆਲੇ ਤੋਂ ਚੰਡੀਗੜ੍ਹ ਲਈ ਬੁੱਕ ਕਰਨਾ ਚਾਹੁੰਦਾ ਹਾਂ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਇਸ ਸਮੇਂ ਦੌਰਾਨ ਤੁਹਾਡੇ ਕੋਲ ਕੋਈ ਗੱਡੀ ਅਵੇਲੇਬਲ ਹੋਏਗੀ ਹਾਂਜੀ ਠੀਕ ਹੈ ਜੀ ਮੇਰਾ ਪੂਰਾ ਨਾਮ ਅਨਮੋਲ ਪ੍ਰੀਤ ਸਿੰਘ ਹੈ ਪਤਾ ਦੋ ਪੰਜ ਸੱਤ ਅਰਬਨ ਸਟੇਟ ਫੇਸ ਥ੍ਰੀ ਪਟਿਆਲਾ ਹਾਂਜੀ ਇਹੀ ਮੇਰੀ ਪਿੱਕਅੱਪ ਲੋਕੇਸ਼ਨ ਹੋਏਗੀ ਅਤੇ ਡਰੋਪ ਲੋਕੇਸ਼ਨ ਏਅਰਪੋਰਟ ਮੋਹਾਲੀ ਠੀਕ ਹੈ ਜੀ ਹਾਂਜੀ ਮੈਨੂੰ ਐਨ ਸਮੇਂ 'ਤੇ ਗਿਆਰਾਂ ਵਜੇ ਗੱਡੀ ਇੱਥੇ ਅ ਖੜ੍ਹੀ ਹੋਣੀ ਚਾਹੀਦੀ ਹੈ ਕਿਉਂਕਿ ਜੇ ਮੈਂ ਲੇਟ ਹੋ ਗਿਆ ਤਾਂ ਮੇਰੀ ਫਲਾਈਟ ਮਿਸ ਹੋ ਜਾਵੇਗੀ ਜਿਹਦੇ ਅਤੇ ਇਸਦੀ ਜ਼ਿੰਮੇਵਾਰੀ ਤੁਹਾਡੀ ਹੋਏਗੀ ਮੈਂ ਤੁਹਾਨੂੰ ਆਸ਼ਾ ਕਰਦਾ ਕਿ ਤੁਸੀਂ ਆਪਣੀ ਗੱਡੀ ਐਨ ਸਮੇਂ 'ਤੇ ਮੇਰੇ ਘਰ ਪਹੁੰਚਾ ਦੇਵੋਗੇ ਅਤੇ ਮੈਨੂੰ ਇਸਦੇ ਰਿਲੇਟਡ ਚਾਰਜਸ ਵਗੈਰਾ ਵੀ ਦੱਸੇ ਜਾਣ ਠੀਕ ਹੈ ਜੀ ਠੀਕ ਹੈ ਦੰਨਿਆਵਾਦ ਜੀ